ਮੈਂ ਇਹ ਮੰਨਦਾ ਹਾਂ ਕਿ ਪੂਰੇ ਹੀ ਭਾਰਤ ਵਿੱਚ ਵਪਾਰ ਅੱਜ ਬਹੁਤ ਹੀ ਵੱਡੇ ਪੱਧਰ 'ਤੇ ਰੋਲ ਪਲੇਅ ਕਰ ਰਿਹਾ ਹੈ ਪੰਜਾਬ ਵਿੱਚ ਇਹ ਭੇਡ ਚਾਲ ਚੱਲ ਰਹੀਂ ਹੈ ਕਿ ਲੋਕ ਆਪਣਾ ਜ਼ਮੀਨ ਆਪਣੀ ਜਾਇਦਾਦ ਵੇਚ ਕੇ ਬਾਹਰ ਜਾ ਰਹੇ ਹਨ ਅਤੇ ਉੱਥੇ ਜਾ ਕੇ ਲੇਬਰ ਕਰ ਰਹੇ ਹਨ ਮੈਂ ਇਹ ਮੰਨਦਾ ਹਾਂ ਕਿ ਅਗਰ ਬੰਦਾ ਸੋਚ ਲਵੇ ਕਿ ਮੈਂ ਇੱਥੇ ਰਹਿ ਕੇ ਹੀ ਕੁਝ ਕਰਨਾ ਹੈ ਤਾਂ ਬੰਦਾ ਬੜੇ ਅਰਾਮ ਦੇ ਨਾਲ ਸਕਸੈਸਫੁੱਲ ਹੋ ਸਕਦਾ ਹੈ ਕਾਫ਼ੀ ਸਾਰੇ ਇੱਥੇ ਕਾਰੋਬਾਰ ਹਨ ਜਿਹੜਾ ਕਿ ਇੱਕ ਬੰਦਾ ਕਰ ਸਕਦਾ ਹੈ ਜਿਵੇਂ ਕਿ ਖਾਣ ਪੀਣ ਨੂੰ ਲੈ ਕੇ ਅੱਜ ਕੱਲ੍ਹ ਬਹੁਤ ਵਪਾਰ ਚੱਲ ਰਹੇ ਹਨ ਕਾਰਾਂ ਕਾਰ ਦੀ ਸੇਲ ਪਰਚੇਸ ਦੀ ਇੰਡਸਟਰੀ ਬਹੁਤ ਵੱਡੇ ਲੈਵਲ 'ਤੇ ਚੱਲ ਰਹੀ ਹੈ ਕੱਪੜਿਆਂ ਨੂੰ ਲੈ ਕੇ ਦੇਖਿਆ ਜਾਵੇ ਤਾਂ ਕੱਪੜਿਆਂ ਦੇ ਸ਼ੋਅਰੂਮ ਬੜੇ ਵਧੀਆ ਤਰੀਕੇ ਨਾਲ ਚੱਲ ਰਹੇ ਹਨ ਅਗਰ ਕਿਸੇ ਕੋਲ ਸ਼ੋਅਰੂਮ ਨਹੀਂ ਵੀ ਹੈਗਾ ਥੋੜ੍ਹੀ ਜੀ ਸਪੇਸ ਆ ਤਾਂ ਉਹ ਥੋੜ੍ਹੀ ਜੀ ਸਪੇਸ ਦੇ ਨਾਲ ਹੀ ਕੰਮ ਨੂੰ ਬੜੇ ਵਧੀਆ ਤਰੀਕੇ ਨਾਲ ਚਲਾ ਸਕਦਾ ਹੈ ਜਿਵੇਂ ਕਿ ਆਪਣੀਆਂ ਰੀਲਸ ਪਾ ਕੇ ਇੰਸਟਾਗ੍ਰਾਮ 'ਤੇ ਆਪਣਾ ਰੇਟ ਪਾ ਦੇ ਅਤੇ ਆਪਣੇ ਕੱਪੜਿਆਂ ਦੀ ਫੋਟੋਆਂ ਪਾ ਦੇ ਵੀਡੀਓ ਪਾ ਦੇ ਉਹਦੇ ਨਾਲ ਲੱਖਾਂ ਹੀ ਲੋਕ ਉਸ ਨੂੰ ਵੇਖਦੇ ਆ ਅਤੇ ਉੱਥੇ ਤੱਕ ਪਹੁੰਚ ਕਰਦੇ ਆ ਚੀਜ਼ ਨੂੰ ਪਰਚੇਸ ਕਰਨ ਦੇ ਲਈ ਸੋ ਲੋਕਾਂ ਨੂੰ ਇੱਥੇ ਰਹਿ ਕੇ ਹੀ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਕਿਉਂਕਿ ਜਿੰਨਾਂ ਸਕਸੈਸਫੁੱਲ ਆਪਾਂ ਆਪਣੇ ਵਪਾਰ 'ਚ ਹੋ ਸਕਦੇ ਹਾਂ ਉਨਾਂ ਕਾਮਯਾਬ ਆਪਾਂ ਕਦੇ ਵੀ ਕਿਸੇ ਦੇ ਅੰਦਰ ਜੋਬ ਕਰਕੇ ਨਹੀਂ ਹੋ ਸਕਦੇ ਸੋ ਸਭ ਤੋਂ ਪਹਿਲੀ ਚੀਜ਼ ਸਾਨੂੰ ਇਹ ਧਿਆਨ ਰੱਖਣੀ ਚਾਹੀਦੀ ਹੈ ਕਿ ਸਾਨੂੰ ਆਪਣੀ ਸ਼ਹਿਰ ਵਿੱਚ ਰਹਿ ਕੇ ਹੀ ਕੰਮ ਕਰਨ ਦੀ ਮੋਟੀਵੇਸ਼ਨ ਲਿਆਉਣੀ ਚਾਹੀਦੀ ਹੈ ਅਤੇ ਇੱਥੇ ਹੀ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਅਗਰ ਆਪਾਂ ਕਿਸੇ ਦੇ ਅੰਡਰ ਕੰਮ ਕਰਦੇ ਹਾਂ ਤਾਂ ਉਸ ਨੂੰ ਜ਼ਿਆਦਾ ਫ਼ਾਇਦਾ ਪਹੁੰਚਾਉਂਦੇ ਹਾਂ ਆਪਣੀ ਸਿਹਤ ਵੀ ਖ਼ਰਾਬ ਕਰਦੇ ਹਾਂ ਜ਼ਿਆਦਾ ਸਮੇਂ ਤੱਕ ਕੰਮ ਵੀ ਕਰਦੇ ਹਾਂ ਤਾਂ ਫ਼ਾਇਦਾ ਉਹਦਾ ਮਾਲਿਕ ਨੂੰ ਹੁੰਦਾ ਹੈ ਸੋ ਸਾਨੂੰ ਇਹੋ ਜਿਹਾ ਕੋਈ ਸਟੈੱਪ ਲੈਣਾ ਚਾਹੀਦਾ ਹੈ ਜਿਸ ਨਾਲ ਆਪਾਂ ਆਪਣਾ ਹੀ ਵਪਾਰ ਸ਼ੁਰੂ ਕਰ ਸਕੀਏ ਅਤੇ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦੇ ਸਕੀਏ